ਅਸੀਂ ਸੋਚਦੇ ਹਾਂ ਕਿ ਜੋ ਵੀ ਪਰਵਾਹ ਜਾਂ ਪਲ ਵਿੱਚ ਹੋਣ ਦੀ ਧਾਰਨਾ ਯੋਗਾ ਦੇ ਅਭਿਆਸ ਨਾਲ ਜੁੜੀ ਹੋਈ ਹੈ ਜੋ ਅਸੀਂ ਸੰਬੰਧ ਕਿਸੇ ਸੰਬੰਧ ਦੇ ਵਿੱਚ ਸੰਬੰਧਿਤ ਨਾਲ ਹੈ ਅਤੇ ਧਿਆਨ ਯੋੋਗਾ ਕਰਦੇ ਸਮੇਂ ਜੋ ਵੀ ਮਤਲਬ ਅਸੀਂ ਕਹਿੰਦੇ ਆ ਵੀ ਧਿਆਨ ਪੂਰਾ ਉਸ ਪਲ ਵਿੱਚ ਹੁੰਦਾ ਹੈ ਭਟਕਣਾ ਨਹੀਂ ਹੁੰਦੀ ਅਤੇ ਭਟਕਾਉਣਾ ਨਹੀਂ ਚਾਹੀਦਾ ਆਸਣ ਕਰਦੇ ਸਮੇਂ ਸਾਹ ਵੱਲ ਪੂਰਾ ਧਿਆਨ ਦਿੰਦੇ ਹਾਂ ਕਿਉਂਕਿ ਜਦੋਂ ਵੀ ਆਪਾਂ ਕੋਈ ਆਸਣ ਕਰਦੇ ਹਾਂ ਉਸ ਵਿੱਚ ਸਾਹ ਲੈਣਾ ਬਹੁਤ ਜ਼ਰੂਰੀ ਹੈ ਸਾਹ ਛੱਡਣਾ ਅਤੇ ਲੈਣਾ ਯੋਗਾ ਕਰਨ ਤੋਂ ਬਾਅਦ ਧਿਆਨ ਲਾਉਂਦੇ ਹਾਂ ਜਿਸ ਨਾਲ ਆਪਣੀ ਅੰਤਰ ਆਤਮਾ ਦਾ ਨਿਰੀਖਣ ਹੁੰਦਾ ਹੈ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਆਪਣੇ ਅੰਦਰ ਕੀ ਚੱਲ ਰਿਹਾ ਹੈ ਆਪਾਂ ਨੂੰ ਬਿਲਕੁਲ ਧਿਆਨ ਉੱਥੇ ਹੀ ਲਾਉਣਾ ਪੈਂਦਾ ਹੈ ਅਤੇ ਲਾਉਣਾ ਵੀ ਚਾਹੀਦਾ ਹੈ ਕਿਉਂਕਿ ਆਸੇ ਪਾਸੇ ਧਿਆਨ ਨਹੀਂ ਹੋਣਾ ਚਾਹੀਦਾ ਯੋਗਾ ਕਰਦੇ ਸਮੇਂ ਆਸਣ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਸਰੀਰ ਨੂੰ ਕੋਈ ਤਕਲੀਫ ਨਾ ਹੋਵੇ ਕਸ਼ਟ ਨਾ ਹੋਵੇ ਜਿਵੇਂ ਕਿ ਆਪਾਂ ਕੋਈ ਵੀ ਆਸਣ ਕਰਦੇ ਹਾਂ ਲੱਤ ਬਾਂਹ ਆਪਣੀ ਉਸੇ ਸਥਿਤੀ ਵਿੱਚ ਹੋਣੀ ਚਾਹੀਦੀ ਜਿਵੇਂ ਕਿ ਜਿਹੜਾ ਵੀ ਆਪਾਂ ਆਸਣ ਕਰ ਰਹੇ ਹਾਂ ਇਸ ਦੇ ਨਾਲ ਆਪਾਂ ਉਸ ਪਲ ਵਿੱਚ ਰਹਿ ਸਕਦੇ ਹਾਂ ਆਪਣਾ ਦਿਮਾਗ ਅਤੇ ਸਰੀਰ ਵਿੱਚ ਇਕ ਸੁਰਤ ਹੋ ਜਾਂਦੀ ਹੈ ਆਸਣ ਕਰਦੇ ਸਮੇਂ ਆਪਾਂ ਨੂੰ ਬਹੁਤ ਹੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜ਼ਿਆਦਾ ਤਾਂ ਆਪਾਂ ਨੂੰ ਸਾਹ ਅਤੇ ਜ਼ੋਰ ਦੇਣਾ ਚਾਹੀਦਾ ਜੋ ਵੀ ਕੋਈ ਆਪਾਂ ਨੱਕ ਦਾ ਆਸਣ ਕਰਦੇ ਹਾਂ ਤਾਂ ਵੀ ਸਾਹ ਆਪਾਂ ਨੂੰ ਉੱਪਰ ਇੱਕ ਪਾਸੇ ਛੱਡਣਾ ਪੈਂਦਾ ਇੱਕ ਪਾਸੇ ਆਪਾਂ ਨੂੰ ਲੈਣਾ ਪੈਂਦਾ ਹੈ ਅਤੇ ਜਿਵੇਂ ਵੀ ਕੋਈ ਵੀ ਆਸਨ ਸਾਡੇ ਸਰੀਰ ਨੂੰ ਕਸ਼ਟ ਪਹੁੰਚਾਉਂਦਾ ਉਹ ਆਪਾਂ ਨੂੰ ਆਸਣ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿ ਆਪਾਂ ਨੂੰ ਤਕਲੀਫ ਹੋਵੇ ਆਸਣ ਕਰਦੇ ਸਮੇਂ ਅਤੇ ਆਸਣ ਕਰਦੇ ਸਮੇਂ ਜੋ ਆਸਣ ਕਰਦੇ ਸਮੇਂ ਪੂਰਾ ਧਿਆਨ ਨੂੰ ਰੱਖਣਾ ਪੈਂਦਾ ਹੈ ਅਤੇ ਸਰੀਰ ਆਪਣਾ ਭਟਕਾਉਣਾ ਨਹੀਂ ਚਾਹੀਦਾ ਸਾਹ ਵੱਲ ਪੂਰਾ ਧਿਆਨ ਦੇਣਾ ਹੈ ਅਤੇ ਸਰੀਰ ਵਿੱਚ ਇੱਕ ਇਸ ਆਪਣਾ ਦਿਮਾਗ ਅਤੇ ਸਰੀਰ ਵਿੱਚ ਇੱਕ ਸੁਰਤ ਹੋ ਜਾਂਦੀ ਹੈ ਅਤੇ ਉਸੇ ਪਲ ਵਿੱਚ ਹੀ ਰਹਿੰਦੇ ਹਾਂ ਅਤੇ ਉਸੇ ਪਲ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ